ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਰਾਮ ਕੈਟਰਿੰਗ ਤੋਂ ਬੋਲਦੇ ਹਾਂ ਤੁਸੀਂ ਕੌਣ ਬੋਲਦੇ ਹੋ ਹਾਂਜੀ ਕਿੱਥੋਂ ਬੋਲਦੇ ਹੋ ਅੱਛਾ ਠੀਕ ਹੈ ਮੈਮ ਹਾਂਜੀ ਦੱਸੋ ਠੀਕ ਕੀ ਮਦਦ ਸਹਾਇਤਾ ਕਰ ਸਕਦੇ ਹਾਂ ਹਾਂਜੀ ਹਾਂਜੀ ਬਿਲਕੁਲ ਦੱਸੋ ਕਦੋਂ ਪ੍ਰੋਗਰਾਮ ਤੁਹਾਡੇ ਠੀਕ ਹੈ ਮੈਮ ਦਿਨ ਦਾ ਜਾਂ ਰਾਤ ਦਾ ਪ੍ਰੋਗਰਾਮ ਠੀਕ ਹੈ ਮੈਮ ਤੁਹਾਡੇ ਮਤਲਬ ਕਿੰਨੇ ਕੁ ਰਿਸ਼ਤੇਦਾਰ ਹੋਣਗੇ ਠੀਕ ਹੈ ਮੈਡਮ ਜੀ ਡੇਢ ਸੌ ਹੋ ਜਾਵੇਗਾ ਅਰੇਂਜਮੈਂਟ ਤੁਹਾਡਾ ਹੋ ਜਾਵੇਗਾ ਬਾਕੀ ਤੁਸੀਂ ਹੋਰ ਕੀ ਚਾਹੁੰਦੇ ਹੋ ਹਾਂਜੀ ਖਾਣੇ ਵਿੱਚ ਮੈਮ ਮਿੱਠੇ ਦੇ ਵਿੱਚ ਤੁਹਾਨੂੰ ਰਸਮਲਾਈ ਹੋ ਗਈ ਗਰਮ ਗੁਲਾਬ ਜਾਮੁਨ ਹੋ ਗਈ ਆਈਸ ਕ੍ਰੀਮ ਹੋ ਗਈ ਅਤੇ ਅਤੇ ਆਪਣੀ ਸਬਜ਼ੀ ਹੋ ਗਈ ਫਿਰ ਲੰਚ ਹੋ ਗਿਆ ਸ਼ਾਹੀ ਪਨੀਰ ਹੋ ਗਿਆ ਰਾਜਮਾਂਹ ਚਾਵਲ ਹੋ ਗਏ ਅਤੇ ਦਾਲ ਮੱਖਣੀ ਹੋ ਗਈ ਚਾਵਲ ਹੋਣਗੇ ਰਾਇਤਾ ਹੋਏਗਾ ਰੋਟੀਆਂ ਹੋਣਗੀਆਂ ਹਾਂਜੀ ਮੈਮ ਬਸ

ਹਾਂਜੀ ਮੈਮ ਪਰ ਪਰ ਪਲੇਟ ਪੰਜ ਸੌ ਰੁਪਈਆ ਮੈਮ ਮੈਮ ਨਹੀਂ ਅਸੀਂ ਘੱਟ ਤਾਂ ਨਹੀਂ ਕਰਦੇ ਹੈਗੇ ਸਾਡਾ ਫ਼ਿਕਸ ਰੇਟ ਹੀ ਚੱਲਦਾ ਸਾਡਾ ਮਾਰਕਿਟ ਨਹੀਂ ਖਰਾਬ ਕਰਦੇ ਅਸੀਂ ਬਾਕੀ ਕੋਈ ਗੱਲ ਨਹੀਂ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਹਾਂਜੀ ਬਾਕੀ ਤੁਸੀਂ ਮਤਲਬ ਦੱਸੋ ਅਸੀਂ ਕਦੋਂ ਤੁਹਾਡੇ ਆਪਣਾ ਨਾ ਜਿਸ ਜਗ੍ਹਾ 'ਤੇ ਆਪਾਂ ਨੇ ਅਰੇਂਜਮੈਂਟ ਕਰਨਾ ਹੈ ਸਾਨੂੰ ਜਗ੍ਹਾ ਦਿਖਾ ਦਿਉ ਮਤਲਬ ਮੇਰੇ ਨਾਲ ਹਾਂਜੀ

ਠੀਕ ਹੈ ਮੈਮ ਉਹ ਹਾਂਜੀ ਮੈਮ ਇਸ ਤੋਂ ਇਲਾਵਾ ਸਾਡਾ ਡੈਕੋਰੇਸ਼ਨ ਦਾ ਵੀ ਸਾਮਾਨ ਹੁੰਦਾ ਹੈ ਅਤੇ ਆਪਣਾ ਫ਼ਾਸਟ ਫ਼ੂਡ ਦਾ ਵੀ ਹੁੰਦਾ ਹੈ ਬਾਕੀ ਤੁਸੀਂ ਕਰਿਆ ਹੈ ਜਾਂ ਸਾਡੇ ਵੱਲ ਤੋਂ ਹੀ ਹੋਏਗਾ

ਹਾਂਜੀ ਮੈਮ ਮੈਮ ਇਸ ਦਾ ਅਲੱਗ ਤੋਂ ਚਾਰਜ ਹੋਈ ਚਾਰਜ ਹੋਏਗਾ ਕੋਈ ਗੱਲ ਨਹੀਂ ਮੈਮ ਉਹ ਜਗ੍ਹਾ ਦੇਖ ਕੇ ਨਾ ਆਪਾਂ ਜਿੰਨਾ ਵੀ ਹੋਏਗਾ ਉਸ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਦੇਵਾਂਗੇ ਹਾਂਜੀ ਮੈਮ ਮੇਰੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਮੈਮ ਬਾਕੀ ਕੋਈ ਗੱਲ ਨਹੀਂ ਤੁਸੀਂ ਸਾਡਾ ਦੇਖਿਆ ਹੀ ਹੈ ਕੰਮ ਹੈ ਨਾ ਅਤੇ ਹਾਂਜੀ ਮੈਮ ਕੋਈ ਗੱਲ ਨਹੀਂ ਆਪਣਾ ਫੋਨ ਇਹ ਨੰਬਰ ਤੁਹਾਡਾ ਹੀ ਹੈ ਹਾਂਜੀ ਮੈਮ ਕੋਈ ਗੱਲ ਨਹੀਂ ਜਦੋਂ ਮ ਮ ਹਾਂਜੀ ਬਾਕੀ ਇੱਕ ਗੱਲ ਮੈਮ ਜਦੋਂ ਤੁਹਾਡੇ ਅਸੀਂ ਆਵਾਂਗੇ ਨਾ ਨਾਲ ਨਾਲ ਥੌਨੇ ਜਿੱਥੋਂ ਦਾ ਅਡਰੈੱਸ ਦਿੱਤਾ ਸਾਨੂੰ ਉੱਥੇ ਅਸੀਂ ਆਵਾਂਗੇ ਬਾਕੀ ਉਦੋਂ ਦਾ ਤੁਹਾਡਾ ਆ ਕੇ ਤੁਹਾਨੂੰ ਕਾਲ ਕਰਾਂਗੇ ਬਾਕੀ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਜਿੰਨਾ ਵੀ ਜਿੱਦਾਂ ਵੀ ਹਿਸਾਬ ਕਿਤਾਬ ਹੋਏਗਾ ਤੁਹਾਨੂੰ ਦੱਸ ਦੇਵਾਂਗੇ ਠੀਕ ਹੈ ਮੈਮ ਥੈਂਕ ਯੂ